ਭੰਗੜਾ ਐਰੋਬਿਕਸ ਦੇ ਬਾਰੇ ਕੁਛ ਕੁ ਪ੍ਰੇਰਨਾ ਯੋਗਿਕ ਕਹਾਣੀਆਂ ਦੱਸ ਸਕਦਾ ਹਾਂ ਜੋ ਕਿ ਲੋਕਾਂ ਦੇ ਜੀਵਨ ਅਤੇ ਸਿਹਤ ਦੇ ਕਿਵੇਂ ਪ੍ਰਭਾਵ ਪਾਉਂਦੀਆਂ ਹਨ ਜਿਵੇਂ ਕਿ ਭੰਗੜਾ ਦੇ ਐਰੋਬਿਕਸ ਦੇ ਲਾਭ ਕੀ ਕੀ ਹਨ ਇੱਕ ਲਾਭ ਇਹ ਹੈ ਜਿਸਮਾਨੀ ਸਿਹਤ ਕਈ ਲੋਕਾਂ ਨੇ ਦੱਸਿਆ ਹੈ ਕਿ ਭੰਗੜਾ ਐਰੋਬਿਕਸ ਦੇ ਨਾਲ ਬਹੁਤ ਉਹਨਾਂ ਨੂੰ ਆਪਣਾ ਵਜ਼ਨ ਘਟਾਉਣ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਮਿਲਦੀ ਹੈ ਇੱਕ ਇਹ ਵਧੀਆ ਕਾਰਡੀਓ ਵਰਕਆਊਟ ਹੈ ਜੋ ਕਿ ਕੈਲਰੀ ਨੂੰ ਬਰਨ ਕਰਦਾ ਹੈ ਅਤੇ ਹਰਟ ਰੇਟ ਨੂੰ ਵਧਾਉਂਦਾ ਹੈ ਦੂਸਰਾ ਕਾਰਨ ਇਸ ਦੇ ਲਾਭ ਦੇ ਵਿੱਚ ਇਹ ਹੈ ਕਿ ਇਹ ਮਾਨਸਿਕ ਸਿਹਤ ਦੇ ਲਈ ਵਧੀਆ ਹੁੰਦਾ ਹੈ ਨ੍ਰਿੱਤ ਵਜੋਂ ਭੰਗੜਾ ਖੁਸ਼ੀ ਅਤੇ ਜ਼ਿੰਦਾ ਦਿਲੀ ਦਾ ਪ੍ਰਤੀਕ ਹੈ ਕਈਆਂ ਨੇ ਕਿਹਾ ਹੈ ਕਿ ਭੰਗੜਾ ਐਰੋਬਿਕਸ ਕਰਨ ਦੇ ਨਾਲ ਉਹਨਾਂ ਨੂੰ ਡਿਪਰੈਸ਼ਨ ਜਾਂ ਚਿੰਤਾ ਤੋਂ ਰਾਹਤ ਮਿਲਦੀ ਹੈ

ਉਹਨਾਂ ਦੇ ਮੂਡ ਵਿੱਚ ਬਹੁਤ ਹੀ ਸੁਧਾਰ ਆਇਆ ਹੈ ਇਸਦਾ ਇੱਕ ਤੀਜਾ ਲਾਭ ਇਹ ਹੈ ਕਿ ਇਹ ਸਮਾਜਿਕ ਸੰਬੰਧਾਂ ਦੇ ਵਿੱਚ ਮਦਦ ਕਰਦਾ ਹੈ ਜਿਵੇਂ ਕਿ ਭੰਗੜਾ ਐਰੋਬਿਕਸ ਕਲਾਸਾਂ ਵਿੱਚ ਹਿੱਸਾ ਲੈਣ ਵਾਲੇ ਕਈ ਲੋਕਾਂ ਦੇ ਨਵੇਂ ਦੋਸਤ ਬਣਾਉਂਦੇ ਹਨ ਅਤੇ ਸਮਾਜਿਕ ਸੰਬੰਧ ਬਣਾਏ ਜਾਂਦੇ ਹਨ ਜੋ ਕਿ ਉਹਨਾਂ ਨੂੰ ਸਮਾਜਿਕ ਜੀਵਨ ਨੂੰ ਨਵੀਂ ਰੌਸ਼ਨੀ ਵਿੱਚ ਲਿਆਉਂਦਾ ਹੈ ਉਦਾਹਰਣ ਦੇ ਲਈ ਜਸਪ੍ਰੀਤ ਦਾ ਕਹਿਣਾ ਜਸਪ੍ਰੀਤ ਨੂੰ ਸਟੇਟਸ ਵਜੋਂ ਵਜ਼ਨ ਦੀ ਸਮੱਸਿਆ ਹੈ ਪਰ ਉਹ ਭੰਗੜਾ ਐਰੋਬਿਕਸ ਵਿੱਚ ਸ਼ਾਮਿਲ ਹੋਈ ਅਤੇ ਕੁਝ ਮਹੀਨਿਆਂ ਦੇ ਅੰਦਰ ਉਸ ਦਾ ਵਜ਼ਨ ਘੱਟ ਗਿਆ ਅਤੇ ਆਪਣੇ ਸਰੀਰ ਦੇ ਵਿੱਚ ਇੱਕ ਨਵਾਂ ਉਤਸ਼ਾਹ ਮਹਿਸੂਸ ਹੋਇਆ ਉਹ ਕਹਿੰਦੀ ਹੈ ਕਿ ਭੰਗੜਾ ਐਰੋਬਿਕਸ ਦੇ ਨਾਲ ਉਹਦਾ ਸਰੀਰ ਤੰਦਰੁਸਤ ਰਹਿੰਦਾ ਹੈ ਬਲਕਿ ਉਹਦਾ ਸੈਲਫ ਕੋਨਫੀਡੈਂਸ ਵੀ ਵਧਿਆ ਹੈ ਭੰਗੜਾ ਐਰੋਬਿਕਸ ਨਾ ਸਿਰਫ ਸਰੀਰਕ ਵਰਕਆਊਟ ਹੈ ਬਲਕਿ ਇੱਕ ਆਨੰਦ ਮਾਣਨ ਦਾ ਤਰੀਕਾ ਹੈ ਜੋ ਕਿ ਮਾਨਸਿਕ ਸਿਹਤ ਅਤੇ ਸਮਾਜਿਕ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਕਰਦਾ ਹੈ ਜਿਵੇਂ ਕਿ ਪਹਿਲਾਂ ਵੀ ਕਿਹਾ ਸੀ ਕਿ ਮੈਂ ਇਸ ਨੂੰ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਭੰਗੜਾ ਕਰਨ ਦਾ ਇੱਕ ਵਰਕਆਊਟ ਜ਼ਰੀਆ ਮੰਨਦਾ ਹਾਂ ਇਹ ਭੰਗੜਾ ਐਰੋਬਿਕਸ ਬਹੁਤ ਹੀ ਇੱਕ ਫਿਜੀਕਲੀ ਵਰਕਆਊਟ ਹੈ ਜੋ ਕਿ ਤੁਹਾਨੂੰ ਸਿਹਤ ਦੇ ਪੱਖੋਂ ਤੁਹਾਨੂੰ ਚੰਗੀ ਤੰਦਰੁਸਤੀ ਪੈਦਾ ਕਰਦਾ ਹੈ ਧੰਨਵਾਦ